ਹੈਲੋ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਰ ਨਾ ਮੈਂ ਮਸ਼ੀਨਾਂ ਰੱਖੀਆਂ ਸਿਲਾਈ ਵਾਲੀ ਵੀ ਅਤੇ ਬੁਣਾਈ ਵਾਲੀ ਵੀ ਮੈਂ ਇਹਨਾਂ ਦੀ ਬੜੀ ਸਾਂਭ ਰੱਖਦੀ ਹਾਂ ਸਾਫ ਸਫਾਈ ਬੜੀ ਮੈਂ ਕਰਦੀ ਹਾਂ ਜਿਹੜੀ ਚੀਜ਼ ਰੋਜ਼ ਚੱਲਣੀ ਆ ਉਹ ਅਤੇ ਨਹੀਂ ਖਰਾਬ ਹੋ ਹੀ ਜਾਂਦੀ ਹੈ ਉਹ ਕਈ ਵਾਰੀ ਤਾਂ ਮੈਂ ਖ ਆਪੇ ਕਰ ਲੈਂਦੀ ਹਾਂ ਠੀਕ ਮਾੜਾ ਮੋਟਾ ਨੁਕਸ ਹੋਏ ਕਿ ਜਿੱਦਾਂ ਧਾਗਾ ਧੁਗਾ ਫਸਿਆ ਹੋਏ ਮਸ਼ੀਨ ਦੇ ਵਿੱਚ ਉਹ ਮੈਂ ਕੱਢ ਲੈਂਦੀ ਹਾਂ ਅਤੇ ਸਾਫ ਸਫਾਈ ਕਰਦੀ ਹਾਂ ਮਸ਼ੀਨ ਦਾ ਤੇਲ ਮੈਂ ਮਸ਼ੀਨ ਦੇ ਵਿੱਚ ਦਿੰਦੀ ਹਾਂ ਅਤੇ ਕਈ ਵਾਰੀ ਨਹੀਂ ਤਾਂ ਫਿਰ ਮੈਨੂੰ ਕਿੰਨਾਂ ਨੇ ਯੂਟੀਊਬ ਤੋਂ ਦੇਖ ਕੇ ਉਹ ਦੱਸਦੇ ਆ ਉੱਦਾਂ ਵੀ ਕਰਨੀ ਹੈ ਕਈ ਵਾਰੀ ਤਾਂ ਵੀ ਨਹੀਂ ਕਿੰਨਾ ਨਹੀਂ ਹੁੰਦਾ ਫੇਰ ਮੈਂ ਬਾਹਰੋਂ ਮਿਸਤਰੀ ਸੱਦ ਕੇ ਅਤੇ ਸਿਲਾਈ ਮਸ਼ੀਨ ਠੀਕ ਕਰਾਉਂਦੀ ਹਾਂ ਅਤੇ ਜਿਹੜੀ ਉਹ ਦੂਜੀ ਮਸ਼ੀਨ ਹੈ ਸਵੈਟਰ ਬੁਣਨ ਵਾਲੀ ਉਹ ਵੀ ਕਈ ਵਾਰੀ ਹੋ ਜਾਂਦੀ ਆ ਅੱਬਲ ਤਾਂ ਉਹ ਹੁੰਦੀ ਨਹੀਂ ਥੋੜ੍ਹੀ ਕਿਤੇ ਸ ਖਰਾਬ ਅਤੇ ਕਈ ਵਾਰੀ ਜਦੋਂ ਹੋ ਜਾਂਦੀ ਹੈ ਕਈ ਵਾਰੀ ਤਾਂ ਆਪੇ ਠੀਕ ਕਰ ਲੈਂਦੀ ਆ ਨਹੀਂ ਤਾਂ ਫਿਰ ਬਾਹਰੋਂ ਮੈਨੂੰ ਬੁਲਾਉਣਾ ਪੈਂਦਾ ਬਾਹਰੋਂ ਮਿਸਤਰੀ ਨੂੰ ਬੁਲਾ ਕੇ ਫਿਰ ਮੈਂ ਕਰਦੀ ਹਾਂ ਉਹਦਾ ਮੈਂ ਸਾਂਭ ਸਾਂਭ ਬੜੀ ਕਰਦੀ ਹਾਂ ਸਾਫ ਸਫਾਈ ਮੈਂ ਬਹੁਤ ਜ਼ਿਆਦਾ ਰੱਖਣੀ ਹੈ ਵੀ ਜਿਹਦੇ ਤੋਂ ਰੋਟੀ ਕਮਾ ਕੇ ਖਾਣੀ ਹੈ ਉਹ ਸਾਫ ਸੁਥਰਾ ਹੋਏਗਾ ਅਤੇ ਫਿਰ ਹੀ ਕਿੰਨਾ ਨਹੀਂ ਉਹ ਹੋਏਗਾ ਨਾ ਕੱਪੜੇ ਵੀ ਸੀਤੇ ਜਾਣਗੇ ਸਾਰਾ ਕੁਛ ਹੋਏਗਾ ਅਤੇ ਇਹ ਵਾ ਵੀ ਮੈਂ ਸਾਂਭ ਸੰਭਾਲ ਬੜੀ ਕਰਦੀ ਹਾਂ ਕੀ ਕਰਾਂ ਕਿਨਾ ਨਹੀਂ ਉਹ ਹੁੰਦਾ ਠੀਕ ਨਹੀਂ ਕਿੱਦਾਂ ਜ਼ਿਆਦਾ ਹੋ ਜਾਂਦੀ ਹੈ ਖੇ ਅਤੇ ਉਹ ਜ਼ਿਆਦਾ ਫਿਰ ਮੈਂ ਤਾਂ ਕਰਕੇ ਕਿਨਾ ਨਹੀਂ ਘਰ ਬਾਹਰੋਂ ਫਿਰ ਬੁਲਾ ਲੈਂਦੀ ਹਾਂ ਇਹ ਵਾ ਤੇਲ ਤੂਲ ਮੈਂ ਆਪੇ ਦੇ ਲੈਂਦੀ ਹਾਂ ਤੇਲ ਸਾਰਾ ਮਸ਼ੀਨ ਨੂੰ ਖੋਲ੍ਹ ਕੇ ਕਰ ਲੈਂਦੀ ਹਾਂ ਕਈ ਵਾਰੀ ਨਹੀਂ ਮੇਰੇ ਕੋਲ ਸੈਟ ਬਹਿੰਦੀ ਫੇਰ ਮੈਂ ਕਿੰਨਾ ਨਹੀਂ ਬਾਹਰੋਂ ਬੁਲਾ ਕੇ ਅਤੇ ਫਿਰ ਮੈਂ ਉਹਨੂੰ ਨਾ ਉਹ ਮਿਸਤਰੀ ਨੂੰ ਸੱਦ ਕੇ ਉਹਨੂੰ ਫਿਰ ਦੱਸਦੀ ਹਾਂ ਵੀ ਇਹ ਠੀਕ ਤਰ੍ਹਾਂ ਕਿੰਨਾ ਨਹੀਂ ਤੁਸੀਂ ਨਾ ਇਹਨੂੰ ਠੀਕ ਸਹੀ ਕਰੋ ਉਹ ਫਿਰ ਉਹ ਕਰ ਦਿੰਦੇ ਆ